ਬਾਲ ਮਜ਼ਦੂਰੀ ਇੱਕ ਜੁਰਮ ਹੈ ਜੋ ਕਿ ਚੌਦ੍ਹਾਂ ਸਾਲ ਤੋਂ ਨੀਚੇ ਦੇ ਜੀਰੋ ਤੋਂ ਚੌਦ੍ਹਾਂ ਸਾਲ ਦੇ ਬੱਚਿਆਂ ਦੇ ਜਿਹੜੇ ਚੌਦ੍ਹਾਂਂ ਸਾਲ ਤੋਂ ਘੱਟ ਬੱਚੇ ਹੈ ਉਨ੍ਹਾਂ ਤੋਂ ਕਰਵਾਈ ਜਾਂਦੀ ਹੈ ਤਾਂ ਇੱਕ ਜੁਰਮ ਹੈ ਕਿਉਂਕਿ ਸਾਡੇ ਸੰਵਿਧਾਨ ਵਿੱਚ ਵੀ ਇਹਦੇ ਨਾਲ ਇੱਕ ਇਹਦੇ ਲਈ ਇੱਕ ਪ੍ਰੋਵੀਜ਼ਨ ਬਣੀ ਹੋਈ ਹੈ ਸਾਡੀ ਸੰਵਿਧਾਨ ਵਿੱਚ ਵੀ ਅਤੇ ਇਹਦੇ ਲਈ ਇੱਕ ਇੱਕ ਅਲੱਗ ਤੋਂ ਕਾਨੂੰਨ ਵੀ ਬਣਿਆ ਹੋਇਆ ਏ ਜੋ ਕਿ ਬਾਲ ਮਜ਼ਦੂਰੀ ਕਰਵਾਉਂਦੇ ਨੇ ਕਸਬਿਆਂ 'ਚ ਸ਼ਹਿਰਾਂ 'ਚ ਜਿੱਥੇ ਵੀ ਕਰਵਾਉਂਦੇ ਨੇ ਪਿੰਡਾਂ 'ਚ ਕਰਵਾਉਂਦੇ ਨੇ ਤਾਂ ਉਹਨਾਂ ਦੇ ਖਿਲਾਫ ਫਿਰ ਜੋ ਇੱਕ ਐੱਫ ਆਈ ਆਰ ਹੋ ਜਾਂਦੀ ਹੈ ਇਹਨਾਂ ਨੂੰ ਇੱਕ ਜੁਰਮ ਕਿਉਂਕਿ ਇਹ ਜੁਰਮ ਹੈ ਜਿਹੜਾ ਕੋਈ ਇਸ ਜੁਰਮ ਨੂੰ ਕਰਦਾ ਹੈ ਤਾਂ ਫਿਰ ਉਹ ਬੱਚੇ ਨੂੰ ਨਹੀਂ ਜੁਰਮ ਬੱਚੇ ਨੂੰ ਨਹੀਂ ਸਜ਼ਾ ਦਿੱਤੀ ਜਾਂਦੀ ਉਹ ਜਿਹੜਾ ਕਰਵਾ ਰਿਹਾ ਏ ਉਸ ਲਈ ਸਜ਼ਾ ਹੈ ਕਿਉਂਕਿ ਜੀਰੋ ਤੋਂ ਚੌਦ੍ਹਾਂ ਸਾਲ ਦੇ ਬੱਚੇ ਨੂੰ ਇੱਕ ਇੱਦਾਂ ਦੀਆਂ ਜਿੱਦਾਂ ਹਜਾਂ ਅਂ ਇੱਦਾਂ ਦੀਆਂ ਜਿੱਦਾਂ ਪਟਾਕੇ ਬਣਾਉਣ ਦੀ ਫੈਕਟਰੀ ਹੋ ਗਈ ਉੱਥੇ ਲਗਾ ਤਾ ਜੀ ਇੱਟਾਂ ਬਣਾਉਣ ਦਾ ਭੱਠਾ ਹੋ ਗਿਆ ਜੀ ਉੱਥੇ ਲਗਾ ਤਾ ਕਾਰਖਾਨੇ ਹੋਗੇ ਜੀ ਉੱਥੇ ਲਗਾ ਤੇ ਬੱਚੇ ਨੂੰ ਹੋਟਲਾਂ 'ਚ ਭਾਂਡੇ ਮਜਵਾਣ ਲਗਾ ਦਿੱਤੇ ਅਤੇ ਇਹਦੇ 'ਤੇ ਜਿਹੜੇ ਮੁੱਦੇ ਆ ਬਾਲ ਮਜ਼ਦੂਰੀ ਦੇ ਮੁੱਦੇ ਹੈ ਇਹਦੇ 'ਤੇ ਫਿਰ ਜਿਹੜੀ ਇਹ ਜਦੋਂ ਇਹ ਕੋਈ ਕਰਵਾਉਂਦਾ ਹੈ ਕਿਤੇ ਪਤਾ ਚੱਲ ਜਾਂਦਾ ਕਿ ਉੱਥੇ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ ਤਾਂ ਉਸ ਬੰਦੇ 'ਤੇ ਐਟ ਦੀ ਸਪੋਟ ਜਿਹੜਾ ਉਹ ਪੁਲਿਸ ਵੱਲੋਂ ਐਕਸ਼ਨ ਲਿਆ ਜਾਂਦਾ ਹੈ ਅਤੇ ਇਹਦੇ 'ਤੇ ਫਿਰ ਉਹਨੂੰ ਅਦਾਲਤ ਚ' ਆਉਣਾ ਪੈਂਦਾ ਤਾਂ ਫਿਰ ਇੱਕ ਜੁਰਮ ਹੈ ਤਾਂ ਉਹਨੂੰ ਸਜ਼ਾ ਵੀ ਜ਼ਰੂਰ ਮਿਲਦੀ ਹੈ ਅਤੇ ਇਹਦੇ ਨਾਲ ਬੱਚਿਆਂ ਦਾ ਵੀ ਬਹੁਤ ਨੁਕਸਾਨ ਹੈ ਕਿਉਂਕਿ ਦੇਖੋ ਜਿਹੜੇ ਚੌਦ੍ਹਾਂ ਜੀਰੋ ਤੋਂ ਚੌਦਾ ਸਾਲ ਦੇ ਬੱਚੇ ਛੇ ਤੋਂ ਚੋਂਦਾ ਰੱਖ ਲਓ ਜੀ ਜੀਰੋ ਤੋਂ ਚੌਦ੍ਹਾਂ ਛੇ ਸਾਲ ਤੱਕ ਬੱਚੇ ਆਪਣੇ ਮਾਪਿਆਂ ਕੋਲ ਰਹਿੰਦੇ ਨੇ ਛੇ ਤੋਂ ਚੌਦ੍ਹਾਂ ਸਾਲ ਦੇ ਬੱਚੇ ਜਿਹੜੇ ਹੁੰਦੇ ਉਹਨਾਂ ਦਾ ਜਦੋਂ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਉਹਨਾਂ ਨੂੰ ਜਦੋਂ ਪੜ੍ਹਨ ਦਾ ਅਧਿਕਾਰ ਹੀ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਸਿੱਧਾ ਹੀ ਕੰਮ 'ਤੇ ਭੇਜ ਦਿੱਤਾ ਜਾਂਦਾ ਤਾਂ ਉਹਨਾਂ ਦੀ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਨੇ ਤਾਂ ਬਹੁਤ ਸਾਰੀਆਂ ਗੱਲਾਂ ਸਿੱਖਣ ਤੋਂ ਵਾਂਝੀ ਰਹਿ ਜਾਂਦੇ ਉਹਨਾਂ ਦਾ ਆਪਣਾ ਇੱਕ ਜੋ ਅਧਿਕਾਰ ਹੈ ਸਿੱਖਿਆ ਤਾਂ ਅਧਿਕਾਰ ਸਾਨੂੰ ਦਿੱਤਾ ਗਿਆ ਸੰਵਿਧਾਨ ਵਿੱਚ ਤਾਂ ਸਾਡਾ ਉਹ ਤਾਂ ਵਾਝਾਂ ਰਹਿ ਗਿਆ ਉਹਦੀ ਵੀ ਉਲੰਘਣਾ ਹੈ ਦੂਜੇ ਪਾਸੇ ਜੋ ਬਾਲ ਮਜ਼ਦੂਰੀ ਕਰਾਉਂਦੇ ਨੇ ਉਹਦੀ ਵੀ ਉਹ ਤਾਂ ਇੱਕ ਹੈ ਹੀ ਜੁਰਮ ਹੈ ਉਹਦੀ ਤਾਂ ਸਜ਼ਾ ਹੈ ਹੀ ਹੈ ਤਾਂ ਇਸ ਕਰਕੇ ਜਿਹੜੀਆਂ ਇਹ ਇਸਨੂੰ ਰੋਕਿਆ ਜਾਵੇ ਇਸਨੂੰ ਠੱਲ ਪਾਈ ਜਾਵੇ ਇੱਕ ਕਾਨੂੰਨ ਤਾਂ ਬਣਿਆ ਏ ਪਰ ਕਾਨੂੰਨ ਥੋੜ੍ਹਾ ਸਖਤ ਬਣਨਾ ਚਾਹੀਦਾ ਹੈ ਤਾਂ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਕਿਉਂਕਿ ਹਜੇ ਵੀ ਇਨ੍ਹਾਂ ਚੀਜ਼ਾਂ 'ਤੇ ਠੱਲ ਨਹੀਂ ਪਾਈ ਦੇਖੋ ਕਿੰਨੇ ਲੋਕਾਂ ਤੋਂ ਕਿੰਨੇ ਛੋਟੇ ਛੋਟੇ ਬੱਚਿਆਂ ਤੋਂ ਅਸੀਂ ਆਮ ਦੇਖਦੇ ਹਾਂ ਜਦੋਂ ਅਸੀਂ ਜਾ ਰਹੇ ਹੁੰਦੇ ਹਾਂ ਟੋਲਸ 'ਤੇ ਹੁੰਦੇ ਹਾਂ ਜਾਂ ਫਿਰ ਅਸੀਂ ਕਿਤੇ ਰੁਕੇ ਹੁੰਦੇ ਹਾਂ ਤਾਂ ਉੱਥੇ ਬੱਚੇ ਆ ਕੇ ਕਿੱਦਾਂ ਮੰਗਦੇ ਨੇ ਵਿਚਾਰੇ ਭੀਖ ਇਹ ਮੰਗਵਾਈ ਜਾਂਦੀ ਹੈ ਤਾਂ ਹੀ ਮੰਗਦੇ ਨੇ ਇਸ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ ਸਾਡੇ ਜੋ ਸ਼ਹਿਰਾਂ ਦੇ ਜੋ ਡੀ ਸੀ ਸਾਹਿਬਾਨ ਨੇ ਸਰਕਾਰ ਹੈ ਉਹਨਾਂ ਨੂੰ ਇਸਤੇ ਠੱਲ ਪਾਉਣੀ ਚਾਹੀਦੀ ਹੈ ਸਖਤ ਤੋਂ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਕੋਈ ਜੋ ਸਾਡੀ ਜਿਹੜੀ ਸਾਡੇ ਦੇਸ਼ ਦਾ ਭਵਿੱਖ ਹੈ ਉਹ ਪੜ੍ਹੇ ਉਹ ਅੱਗੇ ਵਧੇ